ਮੈਂ ਜੂਨ ਦੇ ਮਹੀਨੇ ਵਿੱਚ ਬੱਸ ਦੀ ਯਾਤਰਾ ਕੀਤੀ ਸੀ ਜਿਹੜੀ ਬੱਸ ਵਿੱਚ ਮੈਂ ਬੈਠੀ ਸੀ ਉਹ ਪੰਜਾਬ ਰੋਡਵੇਜ਼ ਦੀ ਬੱਸ ਸੀ ਅਤੇ ਬੱਸ ਪੰਜਾ ਪਟਿਆਲਾ ਤੋਂ ਰੋਪੜ ਜਾ ਰਹੀ ਸੀ ਮੈਂ ਚੂੰਗੀ ਨੰਬਰ ਚਾਰ ਸਰਹਿੰਦ ਤੋਂ ਬੱਸ ਵਿੱਚ ਬੈਠੀ ਸੀ ਅਤੇ ਬੱਸ ਦੇ ਅੰਦਰ ਬਵੰਜਾ ਸੀਟਾਂ ਸੀ ਜਦੋਂ ਮੈਂ ਬੈਠੀ ਬੱਸ ਦੇ ਅੰਦਰ ਤਾਂ ਸਿਰਫ ਚਾਰ ਜਾਂ ਪੰਜ ਸੀਟਾਂ ਖਾਲੀ ਸੀ ਪਰ ਜਿਵੇਂ ਹੀ ਬੱਸ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਨੂੰ ਕਰੋਸ ਕੀਤੀ ਉਸ ਤੋਂ ਬਾਅਦ ਫਾਟਕ ਬੰਦ ਹੋ ਗਿਆ ਅਤੇ ਜੋ ਫਾਟਕ ਸੀ ਉਹ ਦਸ ਪੰਦਰਾਂ ਮਿੰਟ ਬੰਦ ਰਿਹਾ ਅਤੇ ਲੋਕ ਜਿਹੜੇ ਸੀ ਉਹ ਆਪਣਾ ਸਕੂਟਰ ਫਾਟਕ ਦੇ ਨੀਚੋ ਲੈ ਕੇ ਜਾ ਰਹੇ ਸੀ ਜੋ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਸੀ ਪੰਦਰਾਂ ਤੋਂ ਦਸ ਮਿੰਟ ਬਾਅਦ ਜਿਵੇਂ ਹੀ ਫਾਟਕ ਖੁੱਲ੍ਹਿਆ ਅਤੇ ਬੱਸ ਬੱਸੀ ਪਹੁੰਚੀ ਬੱਸੀ ਪਹੁੰਚਦੇ ਸਾਰ ਹੀ ਜੋ ਸਵਾਰੀਆਂ ਸੀ ਉਹ ਉੱਤਰ ਗਈਆਂ ਅਤੇ ਅੱਧੀ ਤੋਂ ਜ਼ਿਆਦਾ ਬੱਸ ਖਾਲੀ ਹੋ ਗਈ ਪਰ ਉਸ ਤੋਂ ਬਾਅਦ ਜਿਵੇਂ ਹੀ ਬੱਸ ਚੱਲੀ ਅਤੇ ਮੋਰਿੰਡਾ ਪਹੁੰਚੀ ਮੋਰਿੰਡਾ ਵਾਲੇ ਪੁੱਲ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਪਾਣੀ ਹੋਣ ਕਰਕੇ ਬੱਸ ਨੂੰ ਆਪਣਾ ਰੂਟ ਚੇਂਜ ਕਰਨਾ ਪੈ ਗਿਆ ਅਤੇ ਰੂਟ ਚੇਂਜ ਕਰਨ ਦੇ ਕਾਰਨ ਜੋ ਬੱਸ ਸੀ ਉਹ ਦਸ ਮਿੰਨਟ ਲੇਟ ਹੋ ਗਈ ਬੱਸ ਸਟੈਂਡ ਪਹੁੰਚਣ ਵਾਸਤੇ ਜਿਵੇਂ ਹੀ ਬੱਸ ਸਟੈਂਡ ਪਹੁੰਚੀ ਬੱਸ ਦਸ ਸਵਾਰੀ ਚੜ੍ਹ ਗਈਆਂ ਅਤੇ ਉਸ ਤੋਂ ਬਾਅਦ ਜਿਹੜੀ ਬੱਸ ਸੀ ਉਹ ਔਲਮੋਸਟ ਪੂਰੀ ਭਰ ਗਈ ਮੋਰਿੰਡਾ ਤੋਂ ਰੋਪੜ ਵਾਲੀ ਜਿਹੜੀ ਰੂਟ ਸੀ ਉਹ ਬਿਲਕੁਲ ਠੀਕ ਰਿਹਾ ਅਤੇ ਰੋਡ ਬਿਲਕੁਲ ਸਹੀ ਸੀ ਇੱਕ ਟੋਲ ਪਲਾਜ਼ਾ ਆਇਆ ਰਸਤੇ ਦੇ ਅੰਦਰ ਅਤੇ ਉਹ ਕਰੋਸ ਕਰਨ ਤੋਂ ਬਾਅਦ ਰੋਪੜ ਦਾ ਮੇਨ ਪੁੱਲ ਆਇਆ ਅਤੇ ਮੇਨ ਪੁੱਲ 'ਤੇ ਜਾਂਦੇ ਜਾਂਦੇ ਹੀ ਰੋਪੜ 'ਚ ਬੱਸ 'ਤੇ ਜਿਹੜੀ ਸਵਾਰੀਆਂ ਚੜ੍ਹੀਆਂ ਸੀ ਉਹ ਉੱਤਰ ਗਈਆਂ ਅਤੇ ਉਸ ਤੋਂ ਬਾਅਦ ਬੱਸ ਰੋਪੜ ਤੋਂ ਅਨੰਦਪੁਰ ਸਾਹਿਬ ਚਲੀ ਗਈ